ਪੇਂਡੂ ਅਤੇ ਸ਼ਹਿਰੀ ਅਧਿਆਪਨ ਬਾਰੇ ਮੇਰੇ ਬਹੁਤ ਸਾਰੇ ਵਿਚਾਰ ਹੈਗੇ ਹੈ ਇਹਦੇ ਵਿੱਚੋਂ ਕੁਛ ਕੁ ਤੁਹਾਡੇ ਨਾਲ ਮੈਂ ਸਾਂਝੇ ਕਰਨ ਲੱਗਾ ਜਿੱਦਾਂ ਆਪਾਂ ਸਭ ਤੋਂ ਪਹਿਲਾਂ ਆਪਾਂ ਪਿੰਡ ਵੱਲ ਸ਼ੁਰੂ ਕੀਤਾ ਜਾਵੇ ਤਾਂ ਪਿੰਡ ਵੱਲ ਨਾ ਤਾਂ ਪਿੰਡ ਪੂਰੀ ਤਰ੍ਹਾਂ ਵਿਕਸਤ ਹੁੰਦੇ ਹੈਗੇ ਹੈ ਅਤੇ ਨਾ ਹੀ ਪਿੰਡਾਂ ਵਿੱਚ ਕੋਈ ਵੀ ਜ਼ਿਆਦਾ ਜਿਹੜਾ ਸਿੱਖਿਆ ਦਾ ਪੱਧਰ ਹੈ ਉਹ ਕਾਫੀ ਉੱਚਾ ਹੁੰਦਾ ਹੈਗਾ ਹੈ ਕਿਉਂਕਿ ਜੇ ਆਪਾਂ ਐਜ਼ ਕੰਪੇਅਰ ਟੂ ਆਪਾਂ ਸ਼ਹਿਰ ਨੂੰ ਦੇਖਿਆ ਜਾਵੇ ਤਾਂ ਸ਼ਹਿਰ ਵੀ ਜਿਹੜਾ ਉਹਦਾ ਉੱਥੇ ਦਾ ਜਿਹੜਾ ਸਿੱਖਿਆ ਦਾ ਪੱਧਰ ਹੈ ਉਹ ਕਾਫੀ ਉੱਚਾ ਹੁੰਦਾ ਹੈਗਾ ਹੈ ਕਿਉਂਕਿ ਉੱਥੇ ਦੇ ਇੱਕ ਤਾਂ ਪੜ੍ਹੇ ਲਿਖੇ ਲੋਕ ਹੁੰਦੇ ਹੈਗੇ ਹੈ ਪਿੰਡਾਂ ਵਿੱਚ ਸ਼ਹਿਰਾਂ ਦੇ ਮੁਕਾਬਲੇ ਘੱਟ ਪੜ੍ਹੇ ਲਿਖੇ ਲੋਕ ਹੁੰਦੇ ਹੈਗੇ ਹੈ ਜਿਹੜਾ ਸ਼ਹਿਰਾਂ ਵਿੱਚ ਹੈ ਸ਼ਹਿਰਾਂ ਵਿੱਚ ਜਿਹੜੇ ਤਾਂ ਜਿੱਦਾਂ ਹੁਣ ਆਪਾਂ ਰੋਪੜ ਦੀ ਗੱਲ ਕੀਤੀ ਜਾਵੇ ਰੋਪੜ ਵਿੱਚ ਬੈਠਣ ਵਾਸਤੇ ਲਾਈਬ੍ਰੇਰੀ ਹੈਗੀ ਹੈ ਪਿੰਡਾਂ ਵਿੱਚ ਇਹਨਾਂ ਚੀਜ਼ਾਂ ਦੀ ਘਾਟ ਹੁੰਦੀ ਹੈਗੀ ਹੈ ਜਿਹੜੇ ਉੱਥੋਂ ਦੇ ਬੱਚੇ ਹੁੰਦੇ ਹੈਗੇ ਹੈ ਇਨ੍ਹਾਂ ਨੂੰ ਇਨ੍ਹਾਂ ਚੀਜ਼ਾਂ ਦੀ ਘਾਟ ਕਰਕੇ ਕਾਫੀ ਪਛੜ ਜਾਂਦੇ ਹੈਗੇ ਹੈ ਸ਼ਹਿਰਾਂ ਦੇ ਮੁਕਾਬਲੇ ਇਸ ਤਰ੍ਹਾਂ ਆਪਾਂ ਦੇਖਿਆ ਜਾਵੇ ਵੀ ਜਿਹੜਾ ਪਿੰਡ ਹੈ ਉਹ ਸ਼ਹਿਰ ਨਾਲੋਂ ਕਿਵੇਂ ਪਛੜਿਆ ਰਹਿੰਦਾ ਹੈ ਤਾਂ ਉਹਦਾ ਇੱਕੋ ਇੱਕ ਰੀਜ਼ਨ ਹੈ ਉਹ ਇੱਕ ਸਾਰਿਆਂ ਨਾਲੋਂ ਪਹਿਲਾ ਰੀਜ਼ਨ ਹੈਗਾ ਹੈ ਇੱਕ ਪੈਸਾ ਅਤੇ ਨੰਬਰ ਦੋ 'ਤੇ ਹੈਗਾ ਐਜੂਕੇਸ਼ਨ ਪਰ ਐਜੂਕੇਸ਼ਨ ਪੈਸੇ ਨਾਲੋਂ ਵੀ ਵੱਡਾ ਰੀਜ਼ਨ ਹੈ